ਮੇਰਾ ਮਨਪਸੰਦ ਪੰਜਾਬੀ ਸ਼ਬਦ ਵਿਰਸਾ ਹੈ ਕਿਉਂਕਿ ਇਸ ਇੱਕ ਸ਼ਬਦ ਵਿੱਚ ਹੀ ਬਹੁਤ ਕੁਛ ਇੱਦਾਂ ਦੀਆਂ ਗੱਲਾਂ ਹਨ ਜਿਹੜੇ ਕਿ ਸਾਡੇ ਸਾਰੇ ਪੰਜਾਬੀ ਸੱਭਿਆਚਾਰ ਨੂੰ ਇੱਕ ਜੁੱਟ ਕਰਦੀਆਂ ਹਨ ਵਿਰਸੇ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਵੀ ਸਾਡਾ ਪੁਰਾਤਨ ਸੱਭਿਆਚਾਰ ਹੈ ਪੁਰਾਣੀ ਰਹਿਣ ਦਾ ਤਰੀਕਾ ਖਾਣ ਪੀਣ ਜਿਹੜੀਆਂ ਸਾਡੀਆਂ ਪੁਰਾਣੀ ਸੱਭਿਆਚਾਰਕ ਗਤੀਵਿਧੀਆਂ ਪੰਜਾਬੀ ਲੋਕ ਗੀਤ ਪੰਜਾਬੀ ਭਸ਼ ਲੋਕ ਭਾਸ਼ਾਵਾਂ ਲੋਕ ਲੋਕ ਗੀਤ ਆਦਿ ਬਹੁਤ ਇੱਦਾਂ ਦੀਆਂ ਚੀਜ਼ਾਂ ਹੈ ਜਿਹੜੀ ਕੀ ਇੱਕ ਹੀ ਸ਼ਬਦ ਵਿਰਸੇ ਨਾਲ ਜੁੜੀਆਂ ਹੋਈਆਂ ਹਨ ਵਿਰਸਾ ਸਾਡਾ ਜਿਹੜਾ ਪੰਜਾਬ ਦਾ ਵਿਰਸਾ ਹੈ ਇੱਕ ਬਹੁਤ ਹੀ ਵੱਡਮੁੱਲਾ ਜਿਹੜਾ ਕਿ ਭਾਗ ਪਾਉਂਦਾ ਹੈ ਪੂਰੀ ਹੀ ਭਾਰਤ ਦੀ ਇੱਕ ਸੰਸਕ੍ਰਿਤੀ ਵਿੱਚ ਕਿਉਂਕਿ ਪੰਜਾਬੀ ਇੱਕ ਵਿਰਸਾ ਬਹੁਤ ਹੀ ਮਹਾਨ ਲੋਕਾਂ ਨਾਲ ਭਰਿਆ ਹੋਇਆ ਹੈ ਸਾਡੇ ਬਹੁਤ ਹੀ ਮਹਾਨ ਜਿਹੜੇ ਲੋਕ ਸੀਗੇ ਉਹ ਪੰਜਾਬੀ ਵਿਰਸੇ ਤੋਂ ਹੀ ਸੀਗੇ ਅਤੇ ਮੈਨੂੰ ਪੰਜਾਬੀ ਪੰਜਾਬੀ ਬੋਲਣ 'ਤੇ ਮਾਣ ਮਹਿਸੂਸ ਇਸ ਲਈ ਹੁੰਦਾ ਹੈ ਕਿਉਂਕਿ ਮੈਂ ਇੱਕ ਇੱਦਾਂ ਦੇ ਸੱਭਿਆਚਾਰ ਨਾਲ ਜੁੜੀ ਹੋਈ ਹਾਂ ਜਿਸ ਦਾ ਇਤਿਹਾਸ ਬਹੁਤ ਹੀ ਵਧੀਆ ਸੀ ਜਿਹਦਾ ਇਤਿਹਾਸ ਗੁਰੂਆਂ ਨਾਲ ਜੁੜਿਆ ਹੋਇਆ ਹੈ ਜਿਹਨਾਂ ਨੇ ਸਾਡੇ ਧਰਮ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਇੱਕ ਨਵਾਂ ਧਰਮ ਸਥਾਪਿਤ ਕੀਤਾ ਹੈ ਜਿਸ ਵਿੱਚ ਕੋਈ ਭੇਦਭਾਵ ਨਹੀਂ ਹੈ ਉਨ੍ਹਾਂ ਨੇ ਗੁਰਦੁਆਰੇ ਬਣਵਾਏ ਹਨ ਮੱਥਾ ਟੇਕਣ ਨੂੰ ਜਿੱਥੇ ਹਰ ਕੋਈ ਆ ਕੇ ਮੱਥਾ ਟੇਕ ਸਕਦਾ ਹੈ ਕਿਸੇ ਨੂੰ ਕੋਈ ਪਾਬੰਦੀ ਨਹੀਂ ਹੈ ਅਤੇ ਗੁਰੂਆਂ ਨੇ ਇੱਕ ਬਹੁਤ ਵਧੀਆ ਤਰੀ ਵਧੀਆ ਜਿਹੜੀ ਹੈ ਸਾਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਸਾਨੂੰ ਹਮੇਸ਼ਾ ਹੀ ਜਿਹੜੇ ਆਪਣੇ ਕਮਾਈ ਦਾ ਕੁਛ ਹਿੱਸਾ ਦਾਨ ਪੁੰਨ ਕਰਨਾ ਚਾਹੀਦਾ ਹੈ ਦਾਨ ਪੁੰਨ ਦਾ ਮਤਲਬ ਹੈ ਕਿ ਕਿਸੇ ਨੂੰ ਰੋਟੀ ਖਵਾਉਣੀ ਚਾਹੀਦੀ ਹੈ ਗਰੀਬ ਲਈ ਇਸ ਲਈ ਗੁਰਦੁਆਰਿਆਂ ਵਿੱਚ ਹਮੇਸ਼ਾ ਹੀ ਇੱਕ ਲੰਗਰ ਦਾ ਕੰਮ ਹੁੰਦਾ ਹੈ ਕਿਉਂਕਿ ਗੁਰ ਗੁਰੂ ਜੀ ਦੇ ਟਾਈਮ 'ਤੇ ਇਹ ਹੁੰਦਾ ਸੀ ਕਿ ਜਦੋਂ ਕਿਸੇ ਨੇ ਗੁਰੂ ਜੀ ਨੂੰ ਮਿਲਣ ਆਉਣਾ ਹੈ ਤਾਂ ਉਹ ਪਹਿਲਾਂ ਆਪਣਾ ਜਿਹੜਾ ਕਿ ਲੰਗਰ ਛਕ ਕੇ ਹੀ ਗੁਰੂ ਜੀ ਨੂੰ ਮਿਲ ਸਕਦੇ ਸੀ ਭਾਵੇਂ ਉਹ ਕੋਈ ਵੱਡੇ ਤੋਂ ਵੱਡਾ ਬੰਦਾ ਹੋਵੇ ਜਾਂ ਛੋਟੇ ਤੋਂ ਛੋਟਾ ਬੰਦਾ ਹੋਵੇ ਉਦੋਂ ਪਹਿਲਾਂ ਇਸ ਇਹ ਕਰਨਾ ਹੀ ਪੈਂਦਾ ਸੀ ਵੀ ਜੇਕਰ ਉਹਨੇ ਲੰਗਰ ਨਹੀਂ ਛਕਿਆ ਤਾਂ ਉਹ ਗੁਰੂ ਜੀ ਨੂੰ ਨਹੀਂ ਮਿਲ ਸਕਦਾ ਅਤੇ ਲੰਗਰ ਛਕਣ ਦੀ ਵੀ ਇੱਕ ਉਹ ਹੈ ਪ੍ਰੰਪਰਾ ਕਿ ਹਰ ਬੰਦੇ ਨੂੰ ਕੋਈ ਉੱਚਾ ਹੋਵੇ ਕੋਈ ਨੀਵਾਂ ਹੋਵੇ ਕੋਈ ਉੱਚੀ ਜਾਤ ਦਾ ਹੋਵੇ ਭਾਵੇਂ ਕੋਈ ਨੀਵੀਂ ਜਾਤ ਦਾ ਹੋਵੇ ਉਹ ਇੱਕ ਕਤਾਰ 'ਚ ਬਹਿ ਕੇ ਹੀ ਸਾਰਿਆਂ ਨਾਲ ਲੰਗਰ ਛਕੂੰਗੇ ਅਤੇ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੋਊਂ ਕੀਤਾ ਜਾਊਂਗਾ ਉਨ੍ਹਾਂ ਨਾਲ ਅਤੇ ਇਸ ਲਈ ਪੰਜਾਬੀ ਬੋਲਣ 'ਤੇ ਮੈਨੂੰ ਇੰਨਾ ਮਾਣ ਹੈ ਕਿਉਂਕਿ ਇਹ ਸਾਡੇ ਇੱਦਾਂ ਦੇ ਗੁਰੂਆਂ ਨਾਲ ਜੁੜੀ ਹੋਈ ਹੈ ਜਿਹਨਾਂ ਨੇ ਸਾਡੇ ਧਰਮ ਵਾਸਤੇ ਬਹੁਤ ਕੁਛ ਕੀਤਾ ਹੈ ਅਤੇ ਇਸ ਵਿੱਚ ਬਹੁਤ ਹੀ ਡੂੰਘਾ ਅਹਿਸਾਸ ਛੁਪਿਆ ਹੋਇਆ ਹੈ